ਅਸੀਂ ਰਿਵਾਇਤੀ ਤੌਰ 'ਤੇ ਪੈੱਨ ਨਾਲ ਹੀ ਕਾਗਜ਼ 'ਤੇ ਲਿਖਦੇ ਆ ਰਹੇ ਹਾਂ ਬਚਪਨ ਤੋਂ ਲੈ ਕੇ ਹੁਣ ਤੱਕ ਅਤੇ ਅੱਜ ਵੀ ਪੈੱਨ ਨਾਲ ਹੀ ਲਿਖਣਾ ਪਸੰਦ ਕਰਦੇ ਹਾਂ ਕਿਉਂਕਿ ਸ਼ੁਰੂ ਤੋਂ ਬਚਪਨ ਤੋਂ ਆਦਤ ਬਣ ਚੁੱਕੀ ਆ ਬਾਕੀ ਸਮੇਂ ਦੇ ਨਾਲ ਨਾਲ ਕਾਫੀ ਜ਼ਿਆਦਾ ਬਦਲਾਅ ਆ ਗਿਆ ਅੱਜ ਦਾ ਸਮਾਂ ਮੋਬਾਇਲ ਲੈਪਟਾਪ ਦਾ ਸਮਾਂ ਲੋਕ ਲੈਪਟੋਪ ਅਤੇ ਮੋਬਾਈਲ 'ਤੇ ਹੀ ਟਾਈਪ ਕਰਨਾ ਪਸੰਦ ਕਰਦੇ ਆ ਉਹ 'ਤੇ ਹੀ ਲਿਖਦੇ ਆ ਉਹ ਤੋਂ ਹੀ ਪੜ੍ਹਦੇ ਆ ਇਹ ਪਿਛਲੇ ਕਈ ਸਾਲਾਂ ਤੋਂ ਇਹ ਤਬਦੀਲੀਆਂ ਹੁੰਦੀਆਂ ਆ ਰਹੀਆਂ ਜਿਵੇਂ ਕਿ ਪਹਿਲਾਂ ਆਪਣੇ ਗੁਰੂ ਇਤਿਹਾਸ ਜਿਵੇਂ ਕਿ ਆਪਣੀਆਂ ਕਥਾਵਾਂ ਗਥਾਵਾਂ ਜੋ ਵੀ ਆ ਪੈੱਨ ਦੇ ਨਾਲ ਹੀ ਲਿਖਤਾਂ ਮਿਲਦੀਆਂ ਵਾ ਉਹ ਸਾਰਾ ਕੁਛ ਅੱਜ ਆਪਾਂ ਨੂੰ ਲੈਪਟੋਪ 'ਤੇ ਇੰਝ ਹੀ ਪੜ੍ਹਨ ਲਈ ਮਿਲ ਜਾਂਦਾ ਵਾ ਆਪਾਂ ਮੋਬਾਇਲ 'ਤੇ ਵੀ ਪੜ੍ਹ ਸਕਦੇ ਹਾਂ ਇਹ ਸਮੇਂ ਦਾ ਬਦਲਾਅ ਜਿਹੜਾ ਵਾ ਵੇਖਣ ਦੇ ਵਿੱਚ ਆ ਰਿਹਾ ਵਾ ਅਤੇ ਹੁਣ ਨਵੀਂ ਟੈਕਨੋਲੋਜੀ ਯੂਜ ਹੋਣ ਡੀ ਆ ਲੈਪਟਾਪ ਮੋਬਾਈਲ ਨੂੰ ਯੂਜ ਕਰ ਰਹੇ ਆ ਅਤੇ ਲੋਕ ਉਹ 'ਤੇ ਹੀ ਲਿਖਣਾ ਪੜ੍ਹਨਾ ਪਸੰਦ ਕਰਦੇ ਆ ਪੈੱਨ ਕਾਗਜ਼ ਨੂੰ ਕੋਈ ਪਸੰਦ ਨਹੀਂ ਕਰਦਾ